ਪੰਜਾਬੀ ਸਾਡੀ ਮਾਂ ਬੋਲੀ ਭਾਸ਼ਾ ਹੈ ਇਸਨੂੰ ਅਸੀਂ ਦੂਜੀਆਂ ਭਾਸ਼ਾ ਨਾਲੋਂ ਬਹੁਤ ਵੱਧ ਪਿਆਰ ਕਰਦੇ ਹਾਂ ਭਾਵੇਂ ਕਿ ਅਸੀਂ ਦੂਸਰੀਆਂ ਭਾਸ਼ਾ ਵੀ ਬੋਲ ਸਕਦੇ ਹਾਂ ਪਰ ਸਭ ਤੋਂ ਪਹਿਲਾਂ ਅਸੀਂ ਮਾਣ ਆਪਣੀ ਮਾਂ ਬੋਲੀ ਨੂੰ ਦਿੰਦੇ ਹਾਂ ਕਿਉਂਕਿ ਇਹ ਸਾਨੂੰ ਸਾਡੇ ਗੁਰੂਆਂ ਕੋਲੋਂ ਮਿਲੀ ਹੈ ਇਸ ਦੇ ਵਿੱਚ ਵਰਤੇ ਗਏ ਸ਼ਬਦ ਵੀ ਬਹੁਤ ਹੀ ਅਣਮੁੱਲੇ ਹਨ ਕੁਝ ਅਜਿਹੇ ਸ਼ਬਦ ਹਨ ਜੋ ਹੋਰ ਕਿਸੇ ਭਾਸ਼ਾ ਵਿੱਚ ਨਹੀਂ ਬੋਲੇ ਜਾ ਸਕਦੇ ਅਤੇ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਸਾਡੀ ਕੋਲ ਬਹੁਤ ਹੀ ਮਹਿੰਗੀ ਭਾਸ਼ਾ ਹੈ ਜਿਵੇਂ ਇਸ ਦੇ ਵਿੱਚ ਸ਼ਬਦ ਅਸੀਂ ਵਰਤਦੇ ਹਾਂ ਉਸਤਾਦ ਸ਼ਬਦ ਮਿੱਤਰ ਸ਼ਬਦ ਭੈਣ ਸ਼ਬਦ ਭਰਾ ਸ਼ਬਦ ਇਹ ਬਹੁਤ ਹੀ ਖੂਬਸੂਰਤ ਸ਼ਬਦ ਹਨ ਅਤੇ ਇਹਨਾਂ ਨੂੰ ਬੋਲ ਕੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਅਤੇ ਆਨੰਦ ਵੀ ਮਿਲਦਾ ਹੈ ਕਿਉਂਕਿ ਅੰਗਰੇਜ਼ੀ ਦੇ ਵਿੱਚ ਸਾਰੇ ਰਿਸ਼ਤੇਦਾਰਾਂ ਨੂੰ ਇੱਕ ਹੀ ਸ਼ਬਦ ਨਾਲ ਬੋਲਿਆ ਜਾਂਦਾ ਹੈ ਅੰਕਲ ਅਤੇ ਅੰਟੀ ਪਰ ਸਾਡੀ ਮਾਂ ਬੋਲੀ ਇਤਨੀ ਅਮੀਰ ਹੈ ਕਿ ਸਾਰਿਆਂ ਵਾਸਤੇ ਸਾਡੇ ਕੋਲ ਵੱਖਰੇ ਵੱਖਰੇ ਸ਼ਬਦ ਹਨ ਅਤੇ ਹੋਰ ਵੀ ਇਸ ਦੇ ਬਹੁਤ ਸਾਰੇ ਸ਼ਬਦ ਹਨ ਜਿਹੜੇ ਕਿ ਕੁਝ ਭਾਸ਼ਾ ਵਿੱਚ ਨਹੀਂ ਬੋਲੇ ਜਾਂਦੇ ਇਹਨਾਂ ਦੇ ਜਿਵੇਂ ਅੱਖਰ ਹਨ ਗੰਘਾਂ ਕੰਗਣ ਸ਼ਬਦ ਹੋ ਗਿਆ ਜਿਵੇਂ ਇਹ ਬਹੁਤ ਹੀ ਖੂਬਸੂਰਤ ਬੋਲੀ ਹੈ ਇਸ ਦੇ ਵਾਕੰਸ਼ ਵੀ ਬਹੁਤ ਹੀ ਵਧੀਆ ਹਨ ਜਿਵੇਂ ਕੁੜੀ ਆਪਣੇ ਵਾਲ ਵਾਹ ਰਹੀ ਹੈ ਇਹ ਬਹੁਤ ਹੀ ਸੁੰਦਰ ਵਾਕੰਸ਼ ਹੈ ਜਿਸ ਦੇ ਵਿੱਚ ਨਾਵ ਵੀ ਹੈ ਵਿਸ਼ੇਸ਼ਣ ਵੀ ਹੈ ਅ ਕਿਰਿਆ ਵੀ ਹੈ ਸਾਰੇ ਇਸ ਦੇ ਵਿੱਚ ਜੋ ਕੰਮ ਕਰ ਰਹੇ ਹਨ